ਹਾਂਜੀ ਸਾਡੇ ਪਿੰਡ 'ਚ ਹੀ ਇੱਕ ਸਪਲਾਈ ਸਟੋਰ ਹੈ ਜਿਸ ਵਿੱਚ ਕਿ ਸਟੇਸ਼ਨਰੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਜੋ ਕਿ ਛੋਟੇ ਬੱਚਿਆਂ ਨੂੰ ਅਤੇ ਦਸਵੀਂ ਬਾਰਵੀਂ ਦੇ ਸਟੂਡੈਂਟਾਂ ਨੂੰ ਮਿਲ ਜਾਂਦੀਆਂ ਹਨ ਕੋਈ ਵੀ ਪ੍ਰੋਜੈਕਟ ਬਣਾਉਣ ਲਈ ਕੋਈ ਅਸਾਈਨਮੈਂਟ ਬਣਾਉਣ ਲਈ ਸਾਨੂੰ ਕਾਫੀ ਚੀਜ਼ਾਂ ਦੀ ਲੋੜ ਹੁੰਦੀ ਹੈ ਅਤੇ ਮੈਂ ਅ ਉਸ ਦੁਕਾਨ 'ਤੇ ਜਾ ਕੇ ਮਤਲਵ ਸਟੇਸ਼ਨਰੀ ਸ਼ਾਪ 'ਤੇ ਜਾ ਕੇ ਉਸ ਚੀਜ਼ ਨੂੰ ਖਰੀਦ ਲੈਂਦੀ ਹਾਂ ਉੱਥੇ ਹਰ ਤਰ੍ਹਾਂ ਦਾ ਸਮਾਨ ਉਪਲਬਧ ਹੁੰਦਾ ਹੈ ਪੁਰਾਣਾ ਤੋਂ ਪੁਰਾਣਾ ਸਮਾਨ ਜੋ ਕਿ ਅੱਜ ਦੇ ਟਾਈਮ ਵਿੱਚ ਨਹੀਂ ਮਿਲਦਾ ਉਹ ਵੀ ਉਹਨਾਂ ਕੋਲ ਹੁੰਦਾ ਹੈ ਅਤੇ ਵਧੀਆ ਤਰੀ ਵਧੀਆ ਰੇਟ 'ਤੇ ਅਤੇ ਵਧੀਆ ਕਿਸਮ ਦਾ ਹੁੰਦਾ ਹੈ ਜਿਨ੍ਹਾਂ ਨੂੰ ਖਰੀਦ ਕੇ ਸਹੀ ਰੇਟ 'ਤੇ ਖਰੀਦ ਕੇ ਮੈਂ ਘਰ ਲਿਆਉਂਦੀ ਹਾਂ ਅਤੇ ਉਹਨਾਂ ਦਾ ਸਮਾਨ ਇੰਨਾ ਕੁ ਵਧੀਆ ਹੁੰਦਾ ਹੈ ਕਿ ਮੇਰੇ ਪ੍ਰੋਜੈਕਟ ਵੀ ਬਹੁਤ ਵਧੀਆ ਲੱਗਦਾ ਹੈ ਅਤੇ ਉਹ ਸਮਾਨ ਮੈਂ ਅਗਲੇ ਅ ਕੰਮ ਲਈ ਵੀ ਵਰਤਦੀ ਹਾਂ ਉਹ ਸਮਾਨ ਪਿਆ ਪਿਆ ਖਰਾਬ ਨਹੀਂ ਹੁੰਦਾ ਉਹਨਾਂ ਸਮਾਨ ਦੀ ਕੁਆਲਿਟੀ ਬਹੁਤ ਵਧੀਆ ਹੈ